ਹਾਂ ਮੈਂ ਗੂਗਲ ਮੈਪਸ ਦੀ ਵਰਤੋਂ ਕੀਤੀ ਹੈ ਸਹੀ ਹੁੰਦੇ ਨੇ ਵਧੀਆ ਮਤਲਬ ਅਗਰ ਤੁਸੀਂ ਕਿਸੇ ਜਗ੍ਹਾ 'ਤੇ ਜਾਣ ਲਈ ਉਹਨਾਂ ਨੂੰ ਲਗਾ ਲਉਂਗੇ ਤੁਹਾਨੂੰ ਜਗ੍ਹਾ 'ਤੇ ਲੈ ਜਾਂਦੇ ਨੇ ਪਰ ਕਈ ਵਾਰੀ ਐਵੇਂ ਦਾ ਹੁੰਦਾ ਜੋ ਰਸਤਾ ਜਿਹੜਾ ਘੁੰਮ ਘੁੰਮਾ ਕੇ ਆਇਆ ਹੁੰਦਾ ਕਈ ਵਾਰੀ ਐਵੇਂ ਦੀਆਂ ਗਲੀਆਂ 'ਚ ਵੜ ਦਿੱਤਾ ਜਾਂਦਾ ਜਿੱਥੋਂ ਅੱਗੇ ਲੰਘਣ ਦਾ ਰਸਤਾ ਨਹੀਂ ਹੁੰਦਾ ਥੋੜ੍ਹੀ ਦਿੱਕਤ ਵੀ ਆਉਂਦੀ ਹੈ ਪਰ ਕਿਸੇ ਨਾ ਕਿਸੇ ਹੱਦ ਤੱਕ ਸਹੀ ਵੀ ਹੁੰਦੇ ਨੇ